ਹਾਂ ਹੈਲੋ ਹਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਰ ਦੱਸੋ ਹਾਂਜੀ ਬੋਲ ਰਿਹਾ ਲਓ ਜੀ ਅੱਛਾ ਜੀ ਠੀਕ ਹੈ ਡੇਢ ਸੌ ਗੱਜ ਦੇਖ ਰਹੇ ਹੋ ਠੀਕ ਹੈ ਜੀ ਠੀਕ ਹੈ ਫੈਮਲੀ ਵਾਲੇ ਹੋ ਸਰ ਕੀ ਮੈਰਿਡ ਹੋ ਜਾਂ ਅਨਮੈਰਿਡ ਹੋ ਸਰ ਮੈਰਿਡ ਹੋ ਕੋਈ ਦਿੱਕਤ ਨਹੀਂ ਭਾਅ ਜੀ ਪ੍ਰੋਪਰਟੀਜ ਆਪਣੇ ਕੋਲ ਬਹੁਤ ਪਈਆਂ ਨੇਗੀਆਂ ਠੀਕ ਹੈ ਤੁਸੀਂ ਕਿਹੜੇ ਪਾਸੇ ਦੇਖ ਰਹੇ ਹੋ ਜੀਰਕਪੁਰ ਵਾਲੇ ਪਾਸੇ ਦੇਖ ਰਹੇ ਹੋ ਮੁਹਾਲੀ ਵਾਲੇ ਪਾਸੇ ਦੇਖ ਰਹੇ ਹੋ ਕੀ ਤੁਹਾਡੀ ਪ੍ਰੈਫਰੈਂਸ ਹੈ ਜੀਕੋਪੁਰ ਜੀਰਕਪੁਰ ਵਾਲੇ ਪਾਸੇ ਕੋਈ ਨਹੀਂ ਭਾਅ ਜੀ ਵੀ ਆਈ ਪੀ ਰੋਡ ਵਾਲੇ ਪਾਸੇ ਸਾਡੇ ਕੋਲ ਬਹੁਤ ਪਲੋਟ ਪਏ ਨੇ ਪਲਾਟ ਵੀ ਪਏ ਨੇ ਜੇ ਤੁਸੀਂ ਕਨਸੈਪਟ ਕਰਨਾ ਸਾਡੇ ਕੋਲ ਕੋਠੀਆਂ ਵੀ ਪਈਆਂ ਨੇ ਜਾਂ ਫਿਰ ਫਲੈਟ ਟਾਈਪ ਵੀ ਪਏ ਨੇ ਗੇ ਜਿੱਦਾਂ ਕਹੋਂਗੇ ਉਸ ਤਰ੍ਹਾਂ ਦਾ ਤੁਹਾਨੂੰ ਦਿਖਾ ਦਾਂਗੇ ਤੁਹਾਡਾ ਬਜਟ ਕੀ ਹੈ ਵੈਸੇ ਪੰਦਰਾਂ ਤੋਂ ਵੀਹ ਦੇ ਵਿਚਾਲੇ ਕੋਈ ਨਹੀਂ ਰਜਿਸਟਰੀ ਤੁਸੀਂ ਆਪਣੇ ਨਾਮ ਕਰਵਾਓਂਗੇ ਕਿ ਮਤਲਵ ਵਾਈਫ ਦੇ ਨਾਮ ਕਰਵਾਓਂਗੇ ਆਪਣੇ ਨਾਮ ਕਰਵਾਓਂਗੇ ਕੋਈ ਨਹੀਂ ਭਾਅ ਜੀ ਆਪਾਂ ਇੱਦਾਂ ਕਰਦੇ ਹਾਂ ਮੈਂ ਅੱਜ ਅ ਓਨਰਸ ਨਾਲ ਗੱਲ ਕਰ ਕੇ ਚਾਬੀਆਂ ਲੈ ਲੈਨਾ ਉਹਨਾਂ ਤੋਂ ਹੈਂ ਆਪਾਂ ਨੈਕਸਟ ਵੀਕ ਅਗਲੇ ਹਫ਼ਤੇ ਦਾ ਆਪਾਂ ਅਪੁਆਇੰਟਮੈਂਟ ਰੱਖ ਲੈਂਦੇ ਕਿ ਜਦੋਂ ਤੁਹਾਨੂੰ ਵੀ ਟਾਈਮ ਲੱਗਦਾ ਹੈਗਾ ਹੈ ਨਾ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਪ੍ਰੋਪਰਟੀ ਵਿਜਿਟ ਕਰ ਲੈਂਦੇ ਹਾਂ ਆਪਾਂ ਹੈ ਨਾ ਬਾਕੀ ਦੀ ਅੱਛਾ ਜੀ ਅੱਛਾ ਕੋਈ ਨਹੀਂ ਉਸ ਤਰ੍ਹਾਂ ਦਾ ਦੇਖ ਲੈਂਦੇ ਹਾਂ ਕੋਈ ਜਿੱਦਾਂ ਕਹੋਗੇ ਤੁਸੀਂ ਹਾਂਜੀ ਹਾਂਜੀ ਕੋਈ ਨਹੀਂ ਭਾਅ ਜੀ ਤੁਸੀਂ ਮੈਨੂੰ ਦਿਓ ਹਫ਼ਤੇ ਕੁ ਦਾ ਟਾਈਮ ਦਿਓ ਮੈਂ ਤੁਹਾਨੂੰ ਹਫ਼ਤੇ ਤੱਕ ਦੱਸ ਦਾਂਗਾ ਹੈ ਨਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਭਾਅ ਜੀ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ